ਸਵੇਰ ਦੇ ਤੁਸੀਂ ਅਗਰ ਨਾਸ਼ਤੇ ਵਿੱਚ ਪਰਾਂਠੇ ਦੱਬ ਕੇ ਖਾਂਦੇ ਹੋ ਰੱਜ ਕੇ ਖਾਂਦੇ ਹੋ ਪਰ ਤੁਸੀਂ ਕੰਮ ਧੰਦਾ ਕੋਈ ਵੀ ਨਹੀਂ ਕਰਦੇ ਅਤੇ ਖਾ ਪੀ ਕੇ ਬਹਿ ਜਾਂਦੇ ਹੋ ਆਰਾਮ ਨਾਲ ਪੈ ਜਾਂਦੇ ਹੋ ਲੇਟ ਜਾਂਦੇ ਹੋ ਥੋੜ੍ਹੀ ਦੇਰ ਬਾਅਦ ਫਿਰ ਤੁਸੀਂ ਕੁਝ ਨਾ ਕੁਝ ਅਗਰ ਖਾਣ ਦੀ ਇੱਛਾ ਰੱਖੋਗੇ ਪਰ ਕੰਮ ਕੋਈ ਵੀ ਨਾ ਕਰੋਗੇ ਤਾਂ ਤੁਹਾਡਾ ਭਾਰ ਵਧਣਾ ਹੀ ਹੈ ਉਹ ਭਾਰ ਵਧਾਉਣਾ ਤਾਂ ਆਪਣੇ ਹੱਥ 'ਚ ਹੈ ਜਿੰਨਾ ਮਰਜ਼ੀ ਵਧਾਈ ਜਾਓ ਜਿੰਨਾ ਮਰਜ਼ੀ ਖਾਧੀ ਜਾਓ ਅਤੇ ਜਿੰਨਾ ਵਿਹਲਾ ਰਹੋਗੇ ਉਹ ਸਾਰਾ ਤੁਹਾਡਾ ਜਿਹੜਾ ਸਿਸਟਮ ਸਰੀਰ ਦਾ ਵਿਗੜ ਜਾਵੇਗਾ ਅਤੇ ਤੁਹਾਡੇ ਭਾਰ ਦੇ ਵਿੱਚ ਵਾਧਾ ਤਾਂ ਹੁੰਦਾ ਹੀ ਰਹੇਗਾ